ਜਦ ਮੈਂ ਕਿਸੇ ਪੇਂਟਿੰਗ ਕੰਪੀਟੀਸ਼ਨ ਵਿੱਚ ਪਾਰਟੀਸਪੇਟ ਕਰਦੀ ਹਾਂ ਤਾਂ ਜ਼ਿਆਦਾਤਰ ਤਾਂ ਉਹਨਾਂ ਦੇ ਵਿੱਚ ਕੋਈ ਨਾ ਕੋਈ ਥੀਮ ਜਾਂ ਕੋਈ ਵਿਸ਼ਾ ਜ਼ਰੂਰ ਦਿੱਤਾ ਹੁੰਦਾ ਹੈ ਜਿਸ ਦੇ ਰਿਲੇਟਿਡ ਮੈਂ ਆਪਣੀ ਪੇਂਟਿੰਗ ਬਣਾਉਂਦੀ ਹਾਂ ਮੈਨੂੰ ਆਪਣੀ ਪੇਟਿੰਗ ਜ਼ਿਆਦਾਤਰ ਮੈਂ ਇਹੀ ਸੋਚ ਕੇ ਬਣਾਉਂਦੀ ਹਾਂ ਕਿ ਉਹ ਸਾਰਿਆਂ ਤੋਂ ਵੱਖਰੀ ਅਤੇ ਸੋਹਣੀ ਲੱਗੇ ਅਤੇ ਜਿਸ ਦੇ ਵਿੱਚ ਜ਼ਿਆਦਾਤਰ ਡਿਟੇਲਿੰਗ ਹੋਵੇ ਕਿਉਂਕਿ ਡਿਟੇਲਿੰਗ ਦੇ ਜ਼ਿਆਦਾ ਨੰਬਰ ਮਿਲਦੇ ਹਨ ਪਰ ਜੇਕਰ ਕਿਸੇ ਕੰਪੀਟੀਸ਼ਨ ਦੇ ਵਿੱਚ ਕੋਈ ਵਿਸ਼ਾ ਨਹੀਂ ਦਿੱਤਾ ਹੋਵੇ ਤਾਂ ਉਸ ਵੇਲੇ ਥੋੜ੍ਹੀ ਵਿਸ਼ਾ ਆਪਣੇ ਵੱਲੋਂ ਚੂਜ਼ ਕਰਨ 'ਚ ਥੋੜ੍ਹੀ ਔਖੀ ਜ਼ਰੂਰ ਆਉਂਦੀ ਹੈ ਪਰ ਮੈਂ ਜ਼ਿਆਦਾਤਰ ਉਹੀ ਵਿਸ਼ੇ ਚੂਜ਼ ਕਰਨਾ ਪਸੰਦ ਕਰਦੀ ਹਾਂ ਜਿਹੜੇ ਉਸ ਵੇਲੇ ਜ਼ਿਆਦਾ ਪ੍ਰਚਲਿਤ ਹਨ ਜਿਵੇਂ ਕਿ ਏਡਜ਼ ਹੋ ਗਿਆ ਡਰੱਗਜ਼ ਹੋ ਗਿਆ ਉਹਨਾਂ ਦੇ ਰਿਲੇਟਿਡ ਜੇ ਕੋਈ ਪੇਂਟਿੰਗ ਬਣਾਈ ਜਾਵੇ ਤਾਂ ਉਹ ਜ਼ਿਆਦਾ ਆਕਰਸ਼ਕ ਅਤੇ ਜ਼ਿਆਦਾ ਫਾਇਦੇਮੰਦ ਵੀ ਲੱਗਦੀ ਹੈ ਅਤੇ ਥੋੜ੍ਹੀ ਉਸ ਨਾਲ ਥੋੜ੍ਹਾ ਲੋਕਾਂ ਨੂੰ ਅਵੇਅਰਨੇਸ ਵੀ ਹੁੰਦੀ ਹੈ